ਇੱਕ ਚੰਗੀ ਫੋਟੋ ਖਿੱਚਣ ਲਈ ਮੈਂ ਬੈਕਗਰਾਊਂਡ ਵਧੀਆ ਦੇਖਣਾ ਚਾਹਵਾਂਗਾ ਜਿੱਥੇ ਬੈਕਗਰਾਊਂਡ ਵਧੀਆ ਹੋਵੇ ਤਾਂ ਉੱਥੇ ਫੋਟੋ ਵਧੀਆ ਹੀ ਆਵੇਗੀ ਅਤੇ ਫੋਟੋ ਖਿੱਚਣ ਤੋਂ ਪਹਿਲਾਂ ਮੈਂ ਕੈਮਰੇ 'ਤੇ ਫੋਕੱਸ ਕਰਾਂਗਾ ਜਿਹਦੀ ਫੋਟੋ ਖਿੱਚ ਰਿਹਾ ਉਹਦੇ ਫੇਸ 'ਤੇ ਕਿਉਂਕਿ ਉਹਦੀ ਫੋਟੋ ਕਲੀਅਰ ਆਵੇ ਅਤੇ ਵਧੀਆ ਵੀ ਲੱਗੇ ਜਿਵੇਂ ਕਿ ਅੱਜ ਕੱਲ੍ਹ ਫਿਰ ਦੇਖਿਆ ਜਾਵੇ ਫ਼ੋਨ 'ਚ ਆਪਣੇ ਫਿਲਟਰ ਹੁੰਦੇ ਨੇ ਜਿਸ ਨਾਲ਼ ਫਿਲਟਰ ਦੀ ਵਰਤੋਂ ਕਰਕੇ ਫੋਟੋ ਹੋਰ ਵੀ ਸੋਹਣੀ ਹੋ ਜਾਂਦੀ ਹੈ